ਜੇਕਰ ਮੈਂ ਆਪਣੇ ਖੇਤਰ ਜਾਂ ਇਲਾਕੇ ਦੀ ਗੱਲ ਕਰਾਂ ਤਾਂ ਹਾਂ ਅਪਰਾਧ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੇ ਹਨ ਇਸ ਦਾ ਕਾਰਨ ਗਰੀਬੀ ਅਤੇ ਬੇਰੁਜ਼ਗਾਰੀ ਦੋਨੋਂ ਹੈ ਬੇਰੁਜ਼ਗਾਰੀ ਗਰੀਬੀ ਇੱਕ ਦੂਜੇ ਨਾਲ ਹੀ ਜੁੜੇ ਹੋਏ ਹਨ ਜੇਕਰ ਇਨਸਾਨ ਕੋਲ ਰੁਜ਼ਗਾਰ ਹੀ ਨਹੀਂ ਹੈ ਅਤੇ ਨਾ ਉਸ ਕੋਲ ਪੈਸਾ ਹੈ ਨਾ ਉਹ ਆਪਣੇ ਖਾਣ ਪੀਣ ਲਈ ਗੁਜ਼ਾਰਾ ਕਰ ਪਾਏਗਾ ਚੰਗੇ ਤਰੀਕੇ ਨਾਲ ਤਾਂ ਕਰਕੇ ਲੋਕ ਨਾ ਗਲਤ ਕੰਮਾਂ ਵਿੱਚ ਪੈ ਜਾਂਦੇ ਹਨ ਆਪਣੀ ਅ ਰੋਜ਼ੀ ਰੋਟੀ ਨੂੰ ਲੈਣ ਲਈ ਆਪਣੇ ਰੋਜ਼ ਮਰਾ ਦੀ ਜੋ ਇੱਛਾਵਾਂ ਹੁੰਦੀਆਂ ਹਨ ਉਹਨਾਂ ਨੂੰ ਪੂਰਾ ਕਰਨ ਲਈ ਉਹ ਗਲਤ ਰਸਤੇ ਵਿਚ ਪੈ ਜਾਂਦੇ ਹਨ